ਮੈਂ ਆਪਣੇ ਮਨਪਸੰਦ ਰੈਸਟੋਰੈਂਟ ਵਿੱਚੋਂ ਭੋਜਨ ਔਡਰ ਕੀਤਾ ਸੀ ਔਡਰ ਦੇਣ ਦਾ ਸਮੇਂ ਕੁਝ ਸੱਤ ਕੁ ਵਜੇ ਦੇ ਕਰੀਬ ਸੀ ਪਰ ਮੈਂ ਹੁਣੇ ਜਾਣਕਾਰੀ ਪ੍ਰਾਪਤ ਕੀਤੀ ਹੈ ਕਿ ਉਹ ਰੈਸਟੋਰੈਂਟ ਮੈਨੂੰ ਸੀ ਓ ਡੀ ਨਕਦ ਭੁਗਤਾਨ ਦੀ ਸੁਵਿਧਾ ਪ੍ਰਦਾਨ ਨਹੀਂ ਕਰ ਰਿਹਾ ਜਿਸ ਕਰਕੇ ਮੈਂ ਆਪਣਾ ਔਡਰ ਰੱਦ ਕਰਨਾ ਚਾਹੁੰਦੀ ਹਾਂ ਔਡਰ ਰੱਦ ਕਰਨਾ ਚਾਹੁੰਦੀ ਹਾਂ ਪਰ ਮੈਂ ਮਹਿਸੂਸ ਕਰਦੀ ਹਾਂ ਕਿ ਇਸ ਤੋਂ ਇਲਾਵਾ ਕਿਸੇ ਹੋਰ ਵਿਧੀ ਵਰਤੋਂ ਕਰਕੇ ਔਡਰ ਲਈ ਭੁਗਤਾਨ ਕਰ ਸਕਦੀ ਹਾਂ ਤਾਂ ਮੈਂ ਰੈਸਟੋਰੈਂਟ ਜਾਂ ਐਪ ਦੇ ਮੈਨੇਜਰਸ ਨੂੰ ਅਪੀਲ ਕਰਦੀ ਹਾਂ ਕਿ ਕਿਰਪਾ ਕਰਕੇ ਰਕਮ ਦੀ ਭੁਗਤਾਨ ਲਈ ਕੋਈ ਹੋਰ ਵਿਧੀ ਬਣਾਈ ਜਾਏ ਤਾਂ ਕਿ ਮੇਰੇ ਮੈਨੂੰ ਅਤੇ ਬਾਕੀ ਹੋਰ ਗ੍ਰਾਹਕਾਂ ਨੂੰ ਡਿਲੀਵਰੀ ਜਾਂ ਔਡਰ ਵਿੱਚ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਡਿਲੀਵਰੀ ਦਾ ਸਮਾਂ ਵੀ ਜਿੰਨਾਂ ਹੋ ਸਕੇ ਉੱਨਾਂ ਘੱਟ ਹੋ ਘੱਟ ਰੱਖਿਆ ਜਾਵੇ ਅਤੇ ਅਪੀਲ ਕਰਦੀ ਹਾਂ ਕਿ ਡਿਲੀਵਰੀ ਬੋਆਏ ਜਾਂ ਜੋ ਡਿਲੀਵਰੀ ਪਾਰਟਨਰ ਨੂੰ ਕਿਹਾ ਜਾਵੇ ਕਿ ਔਡਰ ਸਮੇਂ 'ਤੇ ਪਹੁੰਚਾਇਆ ਜਾਏ ਇਹ ਦੇਖਿਆ ਜਾ ਚੁੱਕਿਆ ਹੈ ਕਿ ਇਹ ਰੈਸਟੋਰੈਂਟ ਤੋਂ ਡਿਲੀਵਰੀ ਦਾ ਸਮੇਂ ਕਾਫੀ ਉੱਪਰ ਥੱਲੇ ਹੋ ਜਾਂਦਾ ਹੈ ਅਤੇ ਮੈਂ ਅਪੀਲ ਕਰਦੀ ਹਾਂ ਕਿ ਜਲਦੀ ਇਸ ਸਮੱਸਿਆ ਨੂੰ ਸੌਲਵ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਵਧੀਆ ਤਰੀਕੇ ਨਾਲ ਡਿਲੀਵਰੀ ਦਾ ਅਤੇ ਭੁਗਤਾਨ ਦਾ ਪ੍ਰਦਾਨ ਕੀਤਾ ਜਾਏ